ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਇੱਥੇ ਵੈਸੇ ਸ਼ਹਿਰ ਤਾਂ ਵੱਡੇ ਵੱਡੇ ਹੈਗੇ ਨੇ ਮੋਹਾਲੀ ਵਧੀਆ ਮੋਹਾਲੀ 'ਚ ਵੀ ਜੋਬ ਬਥੇਰੀਆਂ ਹੈ ਰਹਿਣ ਨੂੰ ਜਗ੍ਹਾ ਵੀ ਵਾਧੂ ਹੈ ਅਤੇ ਲੁਧਿਆਣਾ ਹੈ ਉੱਥੇ ਵੀ ਉੱਥੇ ਵੀ ਦੇਖੋ ਕੱਪੜਾ ਵੀ ਸਸਤਾ ਹੈ ਨਾ ਅਤੇ ਅੰਮ੍ਰਿਤਸਰ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਹਾਂਜੀ ਮੋਹਾਲੀ ਠੀਕ ਹੈ ਜੀ ਹਾਂਜੀ ਅਤੇ ਠੀਕ ਹੈ ਜੀ ਕੋਈ ਨਾ ਜੀ ਕੋਈ ਨਾ ਜ਼ਰੂਰ ਦੱਸੋ ਹਾਂਜੀ ਠੀਕ ਹੈ